ਸਤਿ ਸ਼੍ਰੀ ਅਕਾਲ ਜੀ ਜਿਹੜਾ ਕੋਵਿਡ ਦਾ ਸਮਾਂ ਸੀਗਾ ਉਸ ਨੇ ਸਾਨੂੰ ਬਹੁਤ ਕੁਛ ਸਿਖਾਇਆ ਸੀ ਆਪਣੇ ਪੁਰਾਣੀ ਪਰੰਪਰਾ 'ਤੇ ਵਾਪਸ ਆ ਗਏ ਜਿਹੜਾ ਕ ਕਿਸੇ ਨੂੰ ਹੈਲੋ ਕਰਨਾ ਹੱਥ ਮਿਲਾਉਣਾ ਇਹ ਸਾਡੀ ਜਿਹੜੀ ਸੀਗੀ ਇਹ ਪਰੰਪਰਾ ਨਹੀਂ ਸੀਗੀ ਸਾਡੀ ਸੀਗੀ ਅਸੀਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜਾਂ ਨਮਸਤੇ ਸਾਡਾ ਸੀਗਾ ਪਰ ਆਪਾਂ ਕੀ ਕੀਤਾ ਅੰਗਰੇਜ਼ਾਂ ਪਿੱਛੇ ਲੱਗ ਕੇ ਆਪਾਂ ਹੱਥ ਮਿਲਾਉਣਾ ਸ਼ੁਰੂ ਕੀਤਾ ਜਿਹਦੇ ਨਾਲ ਕਿ ਆਪਾਂ ਹੱਥ ਮਿਲਾਉਂਦੇ ਹੀ ਹਾਂ ਨਾਲ ਬਿਮਾਰੀਆਂ ਵੀ ਦਿੰਦੇ ਹਾਂ ਕਿ ਤੂੰ ਲੈ ਅਤੇ ਤੂੰ ਵੀ ਲੈ ਅਤੇ ਆਪਾਂ ਇੱਕ ਦੂਜੇ ਨੂੰ ਬਿਮਾਰੀਆਂ ਵੀ ਦਿੰਦੇ ਹਾਂ ਕੋਵਿਡ ਦੇ ਸਮੇਂ ਤੋਂ ਬਾਅਦ ਸਭ ਤੋਂ ਵਧੀਆ ਗੱਲ ਤਾਂ ਇਹ ਹੋਈ ਕਿ ਲੋਕ ਹੱਥ ਘੱਟ ਮਿਲਾਉਣ ਲੱਗ ਗਏ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜਾਂ ਨਮਸਤੇ ਬੁਲਾਉਣੀ ਸ਼ੁਰੂ ਕਰਤੀ ਉਹਨਾਂ ਨੇ ਉਸ ਤੋਂ ਬਾਅਦ ਉਹ ਆਪਣੇ ਆਪ ਆਪਣੀ ਸਿਹਤ ਦਾ ਧਿਆਨ ਰੱਖਣ ਲੱਗ ਗਏ ਖਾਣਾ ਵੀ ਹੱਥ ਧੋ ਕੇ ਖਾਂਦੇ ਸੀਗੇ ਖਾਣਾ ਖਾਣ ਤੋਂ ਬਾਅਦ ਵੀ ਹੱਥ ਧੋਣੇ ਜਾਂ ਜੋ ਵੀ ਆ ਲਾਗੇ ਬੰਨੇ ਆਪਣਾ ਸਾਰਾ ਸਾਫ ਸਫਾਈ ਦਾ ਧਿਆਨ ਰੱਖਣ ਲੱਗ ਗਏ ਕੋਵਿਡ ਤੋਂ ਬਾਅਦ ਅਤੇ ਕੋਵਿਡ ਨੇ ਸਾਨੂੰ ਦੇਖਿਆ ਜਾਵੇ ਕੋਵਿਡ ਸਾਡੇ ਵਾਸਤੇ ਚੰਗਾ ਵੀ ਸੀਗਾ ਅਤੇ ਮਾੜਾ ਵੀ ਸੀਗਾ ਕੋਵਿਡ ਨੇ ਸਾਨੂੰ ਬਹੁਤ ਕੁਛ ਸਿਖਾਇਆ ਸਾਫ ਸਫਾਈ ਰੱਖਣੀ ਸਿਖਾਈ ਕੋਵਿਡ ਨੇ ਅਤੇ ਹੋਰ ਵੀ ਅਸੀਂ ਕੋਵਿਡ ਤੋਂ ਬਹੁਤ ਕੁਛ ਸਿੱਖਿਆ ਆ ਕਿ ਕੋਵਿਡ ਦੇ ਟਾਈਮ 'ਚ ਕਿ ਜਿੱਦਾਂ ਬਹੁਤ ਜ਼ਿਆਦਾ ਕੀ ਸੀਗਾ ਪਹਿਲਾਂ ਕੋਵਿਡ ਦੇ ਟਾਈਮ 'ਚ ਵਿਆਹ ਵੀ ਹੋਏ ਹਨ ਜਿਹੜੇ ਪੰਜ ਪੰਜ ਲੋਕ ਲੈ ਕੇ ਗਏ ਆ ਹੁਣ ਬਿਨਾ ਕੋਵਿਡ ਤੋਂ ਕੀ ਕਰਦੇ ਲੋਕ ਬਰਾਤੀ ਕਿੰਨੇ ਕਿੰਨੇ ਇਕੱਠੇ ਕਰਕੇ ਲੈ ਜਾਂਦੇ ਆ ਅਤੇ ਕੁੜੀ ਵਾਲਿਆਂ ਨੂੰ ਦਿੱਕਤ ਆਉਂਦੀ ਹੈ ਕੋਵਿਡ ਦੇ ਟਾਈਮ 'ਚ ਚਲੋ ਇਹ ਸੀਗਾ ਕਿ ਜਦੋਂ ਪੰਜ ਕੁ ਬਰਾਤੀ ਜਾਂਦੇ ਸੀਗੇ ਤਾਂ ਕੁੜੀ ਵਾਲਿਆਂ ਨੂੰ ਸਾਂਭਣੇ ਸੌਖੇ ਹੁੰਦੇ ਸੀਗੇ ਅਤੇ ਜਿਹੜੇ ਮਾਤੜ ਸਾਥੀ ਸੀਗੇ ਉਹ ਵਧੀਆ ਮਤਲਬ ਕਿ ਇਹਨੂੰ ਸੰਭਾਲ ਲਿਆ ਉਹਨਾਂ ਨੇ ਇਸ ਟੈਮ ਨੂੰ ਅਤੇ ਉਹਨਾਂ ਵਾਸਤੇ ਵਧੀਆ ਸੀਗਾ ਅਤੇ ਕੋਵਿਡ ਸਾਨੂੰ ਦੱਸ ਕੇ ਗਿਆ ਕਿ ਕ ਕਿੱਦਾਂ ਮਤਲਬ ਅਸੀਂ ਕਿ ਰਹਿ ਸਕਦੇ ਹਾਂ ਥੋੜ੍ਹੇ 'ਚ ਵੀ ਆਪਣਾ ਗੁਜ਼ਾਰਾ ਹੋ ਸਕਦਾ ਹੈ ਧੰਨਵਾਦ